ਪੰਜਾਬ ਦੇ ਰਿਵਾਇਤੀ ਕੱਪੜੇ ਅਤੇ ਫੈਸ਼ਨ ਸਟਾਇਲ ਵਿੱਚ ਜ਼ਿਆਦਾਤਰ ਕੁੜਤਾ ਪਜਾਮਾ ਅਤੇ ਸਲਵਾਰ ਸੂਟ ਹੀ ਆਉਂਦੇ ਹਨ ਮਰਦਾਂ ਲਈ ਕੁੜਤਾ ਪਜਾਮਾ ਅਤੇ ਔਰਤਾਂ ਲਈ ਸਲਵਾਰ ਸੂਟ ਹੀ ਰਿਵਾਇਤੀ ਕੱਪੜੇ ਹਨ ਕੁੜਤੇ ਪਜਾਮੇ ਦੇ ਅੱਗੋਂ ਵੱਖ ਵੱਖ ਪ੍ਰਕਾਰ ਹੋ ਸਕਦੇ ਹਨ ਜਿਵੇਂ ਸ਼ਹਿਰਾਂ ਦੇ ਵਿੱਚ ਲੋਕ ਕੁੜਤੇ ਨਾਲ ਪਜਾਮਾ ਪਾਉਂਦੇ ਹਨ ਅਤੇ ਪਿੰਡਾਂ ਦੇ ਵਿੱਚ ਝੱਗਾ ਜਾਂ ਚਾਦਰਾ ਪਾਉਂਦੇ ਹਨ ਇਸ ਤਰ੍ਹਾ ਹੀ ਔਰਤਾਂ ਵੀ ਸਲਵਾਰ ਸੂਟ ਔਰਤਾਂ ਦੇ ਸਲਵਾਰ ਸੂਟਾਂ ਵਿੱਚ ਵੀ ਭਿੰਨ ਭਿੰਨ ਪ੍ਰਕਾਰ ਦੇ ਸੂਟ ਆਉਂਦੇ ਹਨ